ਦੋ ਲੱਖ ਸੰਤਾਲੀ ਹਜ਼ਾਰ ਚਾਰ ਸੌ ਪੰਜਾਹ ਤਿੰਨ ਲੱਖ ਪੰਤਾਲੀ ਹਜ਼ਾਰ ਪੰਜ ਸੌ ਸੋਲਾਂ ਚਾਰ ਲੱਖ ਦਸ ਹਜ਼ਾਰ ਅੱਠ ਸੌ ਉੱਨੀ ਸੱਤ ਲੱਖ ਤ੍ਰਿਆਨਵੇਂ ਹਜ਼ਾਰ ਨੌ ਸੌ ਬਿਆਸੀ ਨੌ ਲੱਖ ਅੱਠ ਹਜ਼ਾਰ ਚਾਰ ਸੌ ਤੇਈ